ਹੈਲੋ ਹਾਂਜੀ ਨਮਸਤੇ ਜੀ ਮੈਡਮ ਹਾਂਜੀ ਜ਼ਰੂਰ ਜੀ ਹਮ ਤੁਸੀਂ ਸ਼ਿਫਟ ਕਰਨਾ ਮੈਡਮ ਅੱਛਾ ਤੁਹਾਨੂੰ ਇਹ ਰਾਏ ਕਿਹਨਾਂ ਨੇ ਦਿੱਤੀ ਹੈ ਕਿ ਤੁਸੀਂ ਸ਼ਹਿਰ ਤੋਂ ਛੱਡ ਕੇ ਪਿੰਡ ਦੇ ਵਿੱਚ ਮਤਲਬ ਜ਼ਿਆਦਾ ਉਹ ਹੈ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ ਸਾਡਾ ਏਰੀਆ ਪਠਾਨਕੋਟ ਦੇ ਨਾਲ ਲੱਗਦੇ ਦਰਿਆ ਦੇ ਉੱਤੇ ਪੈਂਦਾ ਸਾਨੂੰ ਦੋ ਨਹਿਰਾਂ ਲੱਗਦੀਆਂ ਦਰਿਆ ਤੋਂ ਦੋ ਨਹਿਰਾਂ ਕੱਟੀ ਦੀਆਂ ਔਰ ਸਾਡਾ ਹੈਗਾ ਹੈ ਸਿਟੀ ਦੇ ਨਾਲ ਬਿਲਕੁਲ ਹਰ ਇੱਕ ਤਰ੍ਹਾਂ ਦੀ ਸਹੂਲਤ ਹੈ ਇੱਥੇ ਤੁਸੀਂ ਰਾਤ ਦੇ ਗਿਆਰ੍ਹਾਂ ਵਜੇ ਵੀ ਅਗਰ ਕੋਈ ਸਾਮਾਨ ਦੀ ਤੁਹਾਨੂੰ ਦਿੱਕਤ ਆਉਂਦੀ ਹੈ ਤੁਸੀਂ ਉੱਥੇ ਜਾ ਕੇ ਕੋਈ ਪੰਜ ਕੁ ਮਿੰਟ ਦਾ ਰਸਤਾ ਹੈ ਤੁਸੀਂ ਜਾ ਸਕਦੇ ਉੱਥੇ ਸਾਮਾਨ ਤੁਹਾਨੂੰ ਮਾਰਕਿਟ ਖੁੱਲ੍ਹੀ ਮਿਲੇਗੀ ਔਰ ਦੂਜਾ ਨੰਬਰ ਇਹ ਕਿ ਹੁਣ ਪਿੰਡਾਂ ਦੇ ਵਿੱਚ ਬੱਚਿਆਂ ਦੀ ਫੈਸਿਲਿਟੀ ਬਹੁਤ ਜ਼ਿਆਦਾ ਹੋ ਗਈ ਸਕੂਲ ਜਿਹੜੇ ਆ ਉਹਨਾਂ ਨੇ ਬੱਸਾਂ ਲਗਾਈਆਂ ਹੋਈਆਂ ਬੱਚਿਆਂ ਲਈ ਡਰੋਪ ਪਿਕਅੱਪ ਸਭ ਕੁਝ ਉਹਨਾਂ ਨੇ ਕਰਨਾ ਹੁੰਦਾ ਔਰ ਜਦੋਂ ਪੇਰੈਂਟਸ ਦੀ ਮ ਮੀਟਿੰਗ ਹੁੰਦੀ ਹੈ ਉਦੋਂ ਵੀ ਉਹ ਬ ਬੱਸਾਂ ਜਿਹੜੀਆਂ ਉਹ ਪੇਰੈਂਟਸ ਨੂੰ ਰ ਰਿਸੀਵ ਕਰਨ ਦੇ ਲਈ ਆਉਂਦੀਆਂ ਦੂਜਾ ਨੰਬਰ ਇਹ ਹੈ ਕੀ ਇੱਧਰ ਹੈਗਾ ਪਲਿਊਸ਼ਨ ਫ੍ਰੀ ਬਿਲਕੁਲ ਪਲਿਊਸ਼ਨ ਫ੍ਰੀ ਮਿਲੇਗਾ ਕਿਉਂ ਕਿਉਂਕਿ ਇੱਧਰ ਫਲਦਾਰ ਬੂਟੇ ਕਾਫੀ ਜ਼ਿਆਦਾ ਪੇੜ ਪੌਦੇ ਇਹ ਚੀਜ਼ਾਂ ਐਂ ਤੁਹਾਨੂੰ ਤਾਂ ਪਿੰਡ ਵਾਲਾ ਜਿਹੜਾ ਮਾਹੌਲ ਹੈ ਵਧੀਆ ਲੱਗਦਾ ਸ਼ਹਿਰ ਦੇ ਨਾਲੋਂ ਕੋਈ ਗੱਲ ਨਹੀਂ ਐਨੀ ਟਾਈਮ ਜੀ ਐਨੀ ਟਾਈਮ